ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਸਰ ਆਪਾਂ ਅਸੀਂ ਕਾਰ ਲੈਣੀ ਸੀ ਸਾਨੂੰ ਮਰੂਤੀ ਕਾਰ ਚਾਹੀਦੀ ਹੈ ਲਾਲ ਰੰਗ 'ਚ ਅੱਛਾ ਨਹੀਂ ਨਹੀਂ ਐਕਚੂਅਲੀ ਨਾ ਜੀ ਸ਼ੌਂਕ ਹੈ ਸਾਡਾ ਅਤੇ ਸਾਨੂੰ ਦਿੱਲੀ ਦਿੱਲੀ ਨੰਬਰ ਚਾਹੀਦਾ ਅੱਛਾ ਜੀ ਔਟੋਮੈਟਿਕ ਮਿਲ ਜਾਊ ਅੱਛਾ ਜੀ ਅਤੇ ਆਪਾਂ ਕਾਗਜ਼ ਪੱਤਰ ਪੂਰੇ ਦੇਵੋਂਗੇ ਜੀ ਅੱਛਾ ਸਰ ਜੇ ਅਸੀਂ ਅਸੀਂ ਪੰਜਾਬ ਤੋਂ ਬੋਲਦੇ ਹਾਂ ਅਸੀਂ ਦਿੱਲੀ ਨੰਬਰ ਪੰਜਾਬ 'ਚ ਕਨਵਰਟ ਕਰਵਾਉਣਾ ਜੇ ਹੋ ਜਾਵੇਗਾ ਜੀ ਬਾਅਦ 'ਚੋਂ ਅੱਛਾ ਤੁਸੀਂ ਕਰਾਦੂੰਗੇ ਜੀ ਅੱਛਾ ਹਾਂ ਅੱਛਾ ਜੀ ਅੱਛਾ ਅਤੇ ਅਲੋਏ ਪਏ ਹੋਣੇ ਚਾਹੀਦੇ ਜੀ ਪੈਸਿਆਂ ਦਾ ਕੋਈ ਚੱਕਰ ਨਹੀਂ ਚਾਹੇ ਸਾਡਾ ਦਸ ਪੰਦਰਾਂ ਹਜ਼ਾਰ ਰੁਪਿਆ ਫਾਲਤੂ ਲੱਗ ਜਾਵੇ ਹਾਂ ਅਤੇ ਸਾਨੂੰ ਏ ਏਸੀ ਏਸੀ ਕਾਰ ਚਾਹੀਦੀ ਹੈ ਅਤੇ ਤੁਸੀਂ ਕਰਵਾ ਨਹੀਂ ਸਕਦੇ ਅੱਛਾ ਕੋਈ ਚੱਕਰ ਨਹੀਂ ਹੈ ਫਾਈਵ ਅਤੇ ਪੰਜ ਗੇਅਰਾਂ ਵਾਲੀ ਚਾਹੀਦੀ ਜੀ ਸਾਨੂੰ ਅੱਛਾ ਜੀ ਅਤੇ ਆਪਣਾ ਸਾਨੂੰ ਨੰਬਰ ਸੈਂਡ ਕਰ ਦਿਓ ਅਤੇ ਵਟਸਐੱਪ ਓਕੇ ਸਰ